ਜੇਕਰ ਅਸੀਂ ਪਿੰਡਾਂ ਬਾਰੇ ਪਿੰਡਾਂ ਦੀਆਂ ਖੇਡਾਂ ਬਾਰੇ ਦੱਸੀਏ ਤਾਂ ਵੈਸੇ ਤਾਂ ਅੱਜ ਕੱਲ੍ਹ ਪਿੰਡਾਂ ਵਿੱਚ ਸਾਰੇ ਤਰ੍ਹਾਂ ਦੀ ਗੇਮ ਖੇਡੀ ਜਾਂਦੀ ਹੈ ਫਿਰ ਵੀ ਮੈਂ ਤੁਹਾਨੂੰ ਕੁਛ ਗੇਮਾਂ ਬਾਰੇ ਦੱਸਦਾ ਜਿਵੇਂ ਕਿ ਪਿੱਠੂ ਪਿੰਡਾਂ ਦੀ ਖੇਡ ਆ ਕਬੱਡੀ ਆ ਕੁਸ਼ਤੀ ਆ ਐੱਸਪ੍ਰੈਸ ਆ ਗੁੱਲੀ ਡੰਡਾ ਹੈ ਵੋਲੀਵਾਲ ਫੁੱਟਵਾਲ ਇਹ ਸਾਰੀਆਂ ਗੇਮਾਂ ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਹਨ ਹੋਰ ਵੀ ਬਹੁਤ ਸਾਰੀਆਂ ਗੇਮਾਂ ਹੈ ਮੈਂ ਤੁਹਾਨੂੰ ਪਿੱਠੂ ਬਾਰੇ ਦੱਸਦਾ ਹਾਂ ਪਿੱਠੂ ਵਿੱਚ ਐਕਸਪਲੇਨ ਕਰਦਾਂ ਹਾਂ ਪਿੱਠੂ ਖੇਡਦੇ ਸਮੇਂ ਬਿੱਕਰੀਆਂ ਨੂੰ ਇੱਕ ਦੇ ਇੱਕ ਨੂੰ ਦੂਜੇ ਦੇ ਉੱਪਰ ਬਿੱਕਰੀ ਨੂੰ ਟਿਕਾਇਆ ਜਾਂਦਾ ਹੈ ਅਤੇ ਦੂਸਰੀ ਟੀਮ ਉਸ ਵੀ ਵਿੱਕਰੀਆਂ ਦੇ ਬੋਲ ਮਾਰ ਕੇ ਉਸ ਨੂੰ ਗੇਰਨਾ ਹੁੰਦਾ ਹੈ ਅਤੇ ਜੋ ਵਿਰੋਧੀ ਟੀਮ ਉਸ ਗੇ ਜਦੋਂ ਗਿਰਦੀਆਂ ਹੈ ਤਾਂ ਉਸ ਨੂੰ ਪੁਰ ਟਿਕਾਉਣ ਇੱਕ ਦੇ ਉੱਪਰ ਇੱਕ ਦੇ ਉਪਰ ਰੱਖਣ ਨਾਲ ਜੋ ਦੂਸਰੀ ਜਿਸ ਬੋਲ ਨਾਲ ਗੇਰੀ ਹੁੰਦੀ ਆ ਉਸ ਬੋਲ ਨਾਲ ਉਸ ਨੂੰ ਉਸ ਦੇ ਉੱਪਰ ਮਾਰ ਕੇ ਆਊਟ ਕੀਤਾ ਜਾਂਦਾ ਹੈ ਇਸ ਨੂੰ ਪਿੰਡਾਂ ਵਿੱਚ ਇਸ ਨੇ ਇਸ ਤਰ੍ਹਾਂ ਪਿੰਡਾਂ ਵਿੱਚ ਪਿੱਠੂ ਗੇਮ ਖੇਡੀ ਜਾਂਦੀ ਹੈ